ਹਾਂਜੀ ਬਿਲਕੁਲ ਸਾਨੂੰ ਉਹਨਾਂ ਇਲਾਕਿਆਂ 'ਚ ਵੀ ਜਾਣ ਦਾ ਮੌਕਾ ਮਿਲਦਾ ਹੈ ਜਿੱਥੇ ਹੋਰ ਭਾਸ਼ਾ ਬੋਲੀ ਜਾਂਦੀ ਹੈ ਜਿਵੇਂ ਕਿ ਚੰਡੀਗੜ੍ਹ ਹਿਮਾਚਲ ਹਰਿਆਣਾ ਕਈ ਵਾਰ ਤਾਂ ਸਾਨੂੰ ਕੋਈ ਕੰਮ ਹੁੰਦਾ ਹੈ ਅਸੀਂ ਤਾਂ ਜਾਂਦੇ ਹਾਂ ਜਾਂ ਫਿਰ ਘੁੰਮਣ ਫਿਰਨ ਲਈ ਜਾਂ ਇਹਨਾਂ ਸਟੇਟਾਂ 'ਚ ਜਾਂਦੇ ਹਾਂ ਯਾ ਫਿਰ ਕੋਈ ਖੇਡ ਪ੍ਰੋਗਰਾਮ ਹੁੰਦਾ ਹੈ ਉਸ ਨੂੰ ਵੀ ਅਟੈਂਡ ਕਰਨਾ ਹੁੰਦਾ ਤਾਂ ਜਾਂਦੇ ਆ ਤਾਂ ਸਾਨੂੰ ਹਰ ਤਰ੍ਹਾਂ ਦੇ ਲੋਕ ਮਿਲਦੇ ਹਨ ਫਿਰ ਅਸੀਂ ਉਨ੍ਹਾਂ ਨਾਲ ਗੱਲਾਂ ਗੱਲਬਾਤ ਕਰਦੇ ਹਾਂ ਤਾਂ ਲੋਕ ਪੰਜਾਬੀ 'ਚ ਵੀ ਗੱਲ ਕਰਦੇ ਆ ਜਾਂ ਫਿਰ ਹਿੰਦੀ 'ਚ ਵੀ ਗੱਲ ਕਰਦੇ ਆ ਕਿਉਂਕਿ ਹਿੰਦੀ ਹਰ ਪੰਜਾਬੀ ਲੋਕਾਂ ਨੂੰ ਸਮਝਣ ਵਿੱਚ ਕਾਫੀ ਆਸਾਨੀ ਹੁੰਦੀ ਹੈ ਅਤੇ ਉਹਨਾਂ ਨੂੰ ਅਸਾਨੀ ਨਾਲ ਸਮਝ ਆ ਸਾਡੀ ਗੱਲ ਕਹੀ ਅਸਾਨੀ ਨਾਲ ਸਮਝ ਆ ਜਾਂਦੀ ਹੈ ਅਤੇ ਉਹ ਵੀ ਬਹੁਤ ਖੁਸ਼ ਹੁੰਦੇ ਹਨ ਜੇਕਰ ਆਪਾਂ ਹੋਰ ਭਾਸ਼ਾਵਾਂ ਦੀ ਗੱਲ ਕਰੀਏ ਤਾਂ ਮਤਲਬ ਕੰਨੜ ਤਾਂ ਇਹ ਕਾਫੀ ਮੁਸ਼ਕਿਲ ਭਾਸ਼ਾਵਾਂ ਹਨ ਜਿਨ੍ਹਾਂ ਨੂੰ ਸਮਝਣ ਵਿੱਚ ਕਾਫੀ ਦਿੱਕਤ ਆਉਂਦੀ ਹੈ ਫਿਰ ਲੋਕ ਇੰਗਲਿਸ਼ ਦਾ ਸਹਾਰਾ ਲੈਂਦੇ ਹਨ ਜੋ ਕਿ ਇੱਕ ਪੜ੍ਹੇ ਲਿਖੇ ਵਿਅਕਤੀ ਲਈ ਸਮਝਣਾ ਇਸ ਨੂੰ ਆਸਾਨ ਹੁੰਦਾ ਹੈ ਤਾਂ ਜ਼ਿਆਦਾਤਰ ਪੰਜਾਬੀ ਹਿੰਦੀ ਵਿੱਚ ਗੱਲਬਾਤ ਕਰਕੇ ਹੀ ਅਸੀਂ ਆਪਸ ਵਿੱਚ ਵਿਚਾਰ ਵਟਾਂਦਰਾਂ ਕਰਦੇ ਹਾਂ